ਕਾਰੋਬਾਰ ਵਿੱਚ ਆਨਲਾਈਨ ਪੇਮੈਂਟ ਕਰਨਾ ਇੱਕ ਬਹੁਤ ਹੀ ਸੁਲਝੀਦਾਰ ਸੁਝਾਅ ਹੈ ਅੱਜ ਕੱਲ੍ਹ ਸਭ ਕੁਝ ਆਨਲਾਈਨ ਹੁੰਦਾ ਹੈ ਅਤੇ ਆਨਲਾਈਨ ਪੇਮੈਂਟ ਕਰਕੇ ਸਾਰਿਆਂ ਲਈ ਬਹੁਤ ਹੀ ਆਸਾਨ ਹੋ ਜਾਂਦਾ ਹੈ ਪੈਸੇ ਕੁਝ ਹੀ ਪਲਾਂ ਵਿੱਚ ਇੱਕ ਬੰਦੇ ਤੋਂ ਦੂਜੇ ਬੰਦੇ ਤੱਕ ਪਹੁੰਚ ਜਾਂਦੇ ਹਨ ਇਸ ਅਨੁਸਾਰ ਇਸਦੇ ਫਾਇਦੇ ਅਤੇ ਨੁਕਸਾਨ ਵੀ ਬਹੁਤ ਹਨ ਫਾਇਦੇ ਇਹ ਹੈ ਕਿ ਸਾਨੂੰ ਆਪਣੇ ਹੱਥਾਂ ਵਿੱਚ ਪੈਸੇ ਦੀ ਰੱਖਣ ਦੀ ਲੋੜ ਨਹੀਂ ਪੈਂਦੀ ਅਸੀਂ ਕਿੱਥੇ ਵੀ ਹੋਈਏ ਅਸੀਂ ਆਸਾਨੀ ਨਾਲ ਕੈਸ਼ ਪੇਮੈਂਟ ਕਿਸੇ ਨੂੰ ਵੀ ਕਰ ਸਕਦੇ ਹਾਂ ਇਸਦਾ ਨੁਕਸਾਨ ਵੀ ਬਹੁਤ ਹੈ ਨੁਕਸਾਨ ਇਹ ਹੈ ਕਿ ਕਿਸੇ ਵੀ ਅੱਜ ਕੱਲ੍ਹ ਕਿਸੇ ਵੀ ਬੰਦੇ ਨਾਲ ਇਸ ਨਾਲ ਫਰੋਡ ਹੋ ਸਕਦਾ ਹੈ ਅਤੇ ਕਈਆਂ ਬੰਦਿਆਂ ਨਾਲ ਫਰੋਡ ਹੋਇਆ ਵੀ ਹੈ ਫਰੋਡ ਜਿਵੇਂ ਕਿ ਇੱਕ ਕੇਸ ਸੀ ਹਾਲਾਂਕਿ ਮੇਰੇ ਮੁਹੱਲੇ ਵਿੱਚ ਹੀ ਇੱਕ ਆਂਟੀ ਰਹਿੰਦੀ ਸੀ ਉਸ ਨਾਲ ਉਸਨੂੰ ਵਟਸਅਪ 'ਤੇ ਇੱਕ ਲਿੰਕ ਆਇਆ ਜਿਸ 'ਤੇ ਲਿਖਿਆ ਸੀ ਕਿ ਤੁਸੀਂ ਇਸ ਨੂੰ ਅਗਰ ਪੇਮੈਂਟ ਕਰਦੇ ਹੋ ਇਸ ਬੰਦੇ ਨੂੰ ਤਾਂ ਤੁਹਾਨੂੰ ਇੰਨੇ ਪੈਸੇ ਰਿਸੀਵ ਹੋਣਗੇ ਤਾਂ ਉਹਨਾਂ ਨੇ ਆਪਣੇ ਸਾਰੇ ਡਿਟੇਲਸ ਉਹਦੇ ਵਿੱਚ ਭਰ ਦਿੱਤੀ ਜਿਹਦੇ ਕਰਕੇ ਉਹਨਾਂ ਦੇ ਬੈਂਕ ਵਿੱਚ ਕਈ ਹੀ ਲੱਖਾਂ ਦੇ ਪੈਸੇ ਚਲੇ ਗਏ ਤਾਂ ਸਾਨੂੰ ਇਸ ਨੂੰ ਇੱਕ ਸਾਵਧਾਨੀ ਤਰੀਕੇ ਨਾਲ ਵਰਤਣਾ ਚਾਹੀਦਾ ਹੈ ਜੋ ਕਿ ਬਹੁਤ ਹੀ ਚੰਗਾ ਹੋਵੇਗਾ